ਸਿੱਖਿਆ ਨੇ ਸਾਡੇ ਸੱਭਿਆਚਾਰਕ ਅਭਿਆਸਾਂ ਨੂੰ ਕਾਫੀ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਜਿਵੇਂ ਕਿ ਅਸੀਂ ਆਪਣੇ ਬੱਚੇ ਨੂੰ ਸਕੂਲ ਵਿੱਚ ਪੜ੍ਹਾਉਂਦੇ ਹਨ ਅਤੇ ਸਕੂਲ ਵਿੱਚ ਇੰਗਲਿਸ਼ ਸਬਜੈਕਟ ਨੂੰ ਕੰਪਲਸਰੀ ਕਰ ਦਿੱਤਾ ਜਾਂਦਾ ਹੈ ਬਟ ਉਹਦੇ 'ਚ ਪੰਜਾਬੀ ਸਬਜੈਕਟ ਵੀ ਮੇਨ ਹੁੰਦਾ ਹੈ ਪਰ ਬੱਚੇ ਨੂੰ ਸਕੂਲ ਵਿੱਚ ਪੰਜਾਬੀ ਬੋਲਣ ਤੋਂ ਮਨ੍ਹਾ ਕੀਤਾ ਜਾਂਦਾ ਹੈ ਅਤੇ ਉਸਨੂੰ ਕਿਹਾ ਜਾਂਦਾ ਹੈ ਕਿ ਤੂੰ ਇੰਗਲਿਸ਼ ਗੱਲ ਕਰੋ ਜਿਸ ਨਾਲ ਸਾਡਾ ਸੱਭਿਆਚਾਰਕ ਕਾਫੀ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ ਇਸ ਤੋਂ ਇਲਾਵਾ ਤੁਸੀਂ ਪੱਛਮੀ ਦੇਸ਼ ਜਿਹੜੇ ਬਾਹਰਲੇ ਮੁਲਕ ਹੈ ਉੱਥੋਂ ਦੇ ਕਲਚਰ ਵੀ ਸਾਡੇ ਪੰਜਾਬ ਵਿੱਚ ਕਾਫੀ ਜ਼ਿਆਦਾ ਆ ਰਿਹਾ ਜਿਸ ਕਰਕੇ ਸਾਡੀ ਮਾਂ ਬੋਲੀ ਨੂੰ ਕਾਫੀ ਜ਼ਿਆਦਾ ਕਾਫੀ ਜ਼ਿਆਦਾ ਪ੍ਰਭਾਵਿਤ ਸਾਡੀ ਮਾਂ ਬੋਲੀ ਕਾਫੀ ਜ਼ਿਆਦਾ ਪ੍ਰਭਾਵਿਤ ਹੋਈ ਹੈ ਅਤੇ ਅਸੀਂ ਆਪਣੀ ਮਾਂ ਬੋਲੀ ਨੂੰ ਪਿਛੜਦੇ ਹੋਏ ਦੇਖ ਰਹੇ ਹਾਂ ਅਤੇ ਸਾਨੂੰ ਆਪਣੇ ਪੰਜਾਬੀ ਭੰਗੜਾ ਵਗੈਰਾ ਗਿੱਧਾ ਵਗੈਰਾ ਤੋਂ ਵੀ ਅਸੀਂ ਹੁਣ ਪਿੱਛੇ ਜਾ ਰਹੇ ਹਾਂ ਅਤੇ ਇਹ ਚੀਜ਼ਾਂ ਹੁਣ ਸਾਡੇ ਜੀਵਨ 'ਚ ਘੱਟ ਨੇ ਅਤੇ ਬਾਹਰਲੀ ਚੀਜ਼ਾਂ ਜ਼ਿਆਦਾ ਪ੍ਰਭਾਵ ਕਰ ਰਹੀਆਂ ਨੇ